ਮੈਂ ਆਪਣੇ ਬਾਗ਼ ਵਿੱਚ ਹਾਈਬ੍ਰਿਡ ਪੌਦਿਆਂ ਤੋਂ ਇਲਾਵਾ ਦੇਸੀ ਪੌਦਿਆਂ ਨੂੰ ਵੀ ਕਾਫ਼ੀ ਗਿਣਤੀ ਵਿੱਚ ਸ਼ਾਮਿਲ ਕਰਦਾ ਹਾਂ ਇਸਦਾ ਕਾਰਨ ਇਹ ਹੈ ਕਿ ਬੇਸ਼ੱਕ ਇਹਨਾਂ ਦੀ ਉਪਜ ਘੱਟ ਹੈ ਪਰ ਇਹਨਾਂ ਦਾ ਸਵਾਦ ਹਾਈਬ੍ਰਿਡ ਪੌਦਿਆਂ ਨਾਲੋਂ ਕਾਫ਼ੀ ਬਿਹਤਰ ਹੈ ਇਸ ਲਈ ਇਹਨਾਂ ਨੂੰ ਸ਼ਾਮਿਲ ਕਰਨਾ ਚੰਗਾ ਸਮਝਦਾ ਹਾਂ ਇਸ ਤੋਂ ਇਲਾਵਾ ਇਹ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਹਨਾਂ ਵਿੱਚ ਕੋਈ ਜੈਨੇਰਿਕ ਚੇਂਜ ਨਹੀਂ ਹੁੰਦੀ ਜੋ ਕਿ ਸਿਹਤ ਲਈ ਵਧੀਆ ਗੱਲ ਹੈ